ਸੋਸ਼ਲ ਮੀਡੀਆ 'ਤੇ ਔਨਲਾਈਨ ਪਲੇਟਫਾਰਮ ਪੰਜਾਬ ਵਿੱਚ ਸਿੱਖਿਆ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਕਈ ਵਾਰੀ ਸਕੂਲਸ ਦੇ ਵਿੱਚ ਜਾਂ ਕੋਲਜਿਸ ਦੇ ਵਿੱਚ ਨਾ ਕਈ ਵਾਰੀ ਟੀਚਰਜ ਨਹੀਂ ਹੁੰਦੇ ਜਾਂ ਫਿਰ ਕਈ ਵਾਰੀ ਟੀਚਰ ਦਾ ਪੜ ਪੜਾਇਆ ਹੋਇਆ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਅਤੇ ਇਹ ਔਨਲਾਈਨ ਪਲੇਟਫਾਰਮ ਹੀ ਹੈ ਜਿਹਦੇ ਥਰੂ ਜਿਹੜਾ ਬੱਚਾ ਹੈ ਉਹ ਜਿ ਜੋ ਚੀਜ਼ ਉਹਨੂੰ ਸਕੂਲ ਜਾਂ ਕੋਲਜ ਵਿੱਚ ਸਮਝ ਨਹੀਂ ਆ ਰਹੀ ਉਹ ਔਨਲਾਈਨ ਪਲੇਟਫਾਰਮ ਦੀ ਹੈਲਪ ਲੈ ਕੇ ਜਿਹੜਾ ਹੈ ਆਪਣੇ ਜਿਹੜੇ ਵੀ ਉਹਦੇ ਡਾਊਟਸ ਵਗੈਰਾ ਹੈ ਉਹ ਉਹਨਾਂ ਨੂੰ ਕਲੀਅਰ ਕਰ ਸਕਦਾ ਆ ਇਹਦੇ ਤੋਂ ਬਿਨਾਂ ਕਈ ਵਾਰੀ ਹੁੰਦਾ ਕਿ ਬੱਚੇ ਦੀ ਕੋਈ ਮਜਬੂਰੀ ਹੈ ਕਿ ਉਹ ਸਕੂਲ ਜਾਂ ਕੋਲਜ ਵਿੱਚ ਨਹੀਂ ਜਾ ਸਕਦਾ ਅਤੇ ਇਹਦੇ ਕਰਕੇ ਉਹ ਆਪਣੇ ਜੋ ਵੀ ਉਹਦੇ ਪੜ੍ਹਾਈ ਨਾਲ ਸੰਬੰਧਿਤ ਜੋ ਵੀ ਉਹਦੇ ਨੋਟਸ ਆ ਜਾਂ ਜੋ ਵੀ ਉਹਨੂੰ ਇੰਨਫੋਰਮੇਸ਼ਨ ਚਾਹੀਦੀ ਆ ਉਹ ਔਨਲਾਈਨ ਪਲੇਟਫਾਰਮ ਤੋਂ ਲੈ ਸਕਦਾ ਆ ਇਹਦੇ ਤੋਂ ਬਿਨਾਂ ਅੱਜ ਕੱਲ੍ਹ ਸਮਾਜ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਜਿਹਦੇ ਬਾਰੇ ਉਹਨਾਂ ਨੂੰ ਵਿੱਚ ਜਿਹੜਾ ਸੋਸ਼ਲ ਮੀਡੀਆ ਹੈ ਉਹ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ ਕਿ ਅਸੀਂ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਆ ਕਿਸੇ ਲੋਕਾਂ ਨੂੰ ਸਿੱਖਿਆ ਦੇਣੀ ਆ ਤਾਂ ਅਸੀਂ ਸੋਸ਼ਲ ਮੀਡੀਆ 'ਤੇ ਜਿਹੜਾ ਆ ਉਹਦੀ ਮ ਮਦਦ ਲੈ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ